ਇੱਕ ਦਿਨ ਮੈਂ ਆਪਣਾ ਫ਼ੋਨ ਸਕਰੋਲ ਕਰ ਰਿਹਾ ਸੀ ਉੱਥੇ ਮੈਨੂੰ ਇੱਕ ਨੋਟੀਫਿਕੇਸ਼ਨ ਆਈ ਕਿ ਐਮਾਜ਼ੋਨ ਗ੍ਰੇਟ ਇੰਡੀਅਨ ਫੈਸਟੀਵਲ ਸੇਲ ਚਾਲੂ ਹੋ ਗਈ ਹੈ ਜਿਸਦੇ ਵਿੱਚ ਐਪਲ ਦੇ ਪ੍ਰੋਡਕਟ ਕਾਫ਼ੀ ਵਾਜਬ ਰੇਟ 'ਤੇ ਮਿਲ ਰਹੇ ਸੀ ਅਤੇ ਮੈਨੂੰ ਇੱਕ ਐਪਲ ਦਾ ਆਈਫੋਨ ਲੈਣ ਦਾ ਬੜਾ ਇੱਕ ਮੇਰਾ ਸੁਪਨਾ ਸੀ ਮੈਂ ਘਰ ਆਪਣੇ ਗੱਲ ਕਰੀ ਅਤੇ ਮੈਂ ਆਪਣੇ ਘਰਦਿਆਂ ਨੂੰ ਕਿਹਾ ਕਿ ਮੈਂ ਇੱਕ ਆਈਫੋਨ ਲੈਣਾ ਹੈ ਅਤੇ ਉਸਦੀ ਸੇਲ ਚੱਲ ਰਹੀ ਹੈ ਤਾਂ ਮੇਰੇ ਘਰਦਿਆਂ ਨੇ ਇੱਕ ਵਾਰ ਵੀ ਮੈਨੂੰ ਨਾਂਹ ਨੁੱਕਰ ਕਰਦੇ ਹੋਏ ਕਿਹਾ ਕਿ ਆਪਣਾ ਤੂੰ ਫ਼ੋਨ ਔਡਰ ਕਰ ਲਵੇ ਅਤੇ ਉੱਥੇ ਮੈਨੂੰ ਇੱਕ ਆਈਫੋਨ ਫੋਰਟੀਨ ਪਲੱਸ ਜਿਹੜਾ ਚਿੱਟੇ ਰੰਗ ਦਾ ਇੱਕ ਮੇਰਾ ਮਨਪਸੰਦ ਦਾ ਰੰਗ ਸੀ ਉਹ ਮੈਨੂੰ ਮਿਲ ਗਿਆ ਅਤੇ ਉਹ ਮੇ ਮੈਨੂੰ ਸੱਤਰ ਹਜ਼ਾਰ ਰੁਪਏ ਦਾ ਪਿਆ ਪਰ ਅਸਲ ਰੇਟ ਉਹਦਾ ਨ ਇੱਕ ਲੱਖ ਰੁਪਇਆ ਸੀ ਕਿਉਂਕਿ ਉਹ ਸੇਲ ਕਰਕੇ ਮੈਨੂੰ ਕਾਫ਼ੀ ਵਾਜਬ ਰੇਟ 'ਤੇ ਮਿਲ ਰਿਹਾ ਸੀ ਅਤੇ ਮੈਂ ਆਪਣਾ ਵਿੱਚ ਪੁਰਾਣਾ ਫ਼ੋਨ ਸੈਮਸੰਗ ਗਲੈਕਸੀ ਐੱਮ ਫੋਰਟੀ ਵਿੱਚ ਵੀ ਕਟਾ ਕੇ ਮੈਨੂੰ ਉਸਦਾ ਵੀ ਬਹੁਤ ਵਧੀਆ ਰੇਟ ਮਿਲਿਆ ਅਤੇ ਉਸਦੇ ਕਾਰਨ ਮੈਨੂੰ ਫ਼ੋਨ ਸੱਤਰ ਸੱਤਰ ਹਜ਼ਾਰ ਦਾ ਮਿਲ ਗਿਆ ਸੀ ਅਤੇ ਐਮਾਜ਼ੋਨ ਵਾਲਿਆਂ ਨੇ ਇੱਕ ਹੋਰ ਔਫਰ ਲਾ ਰੱਖੀ ਸੀ ਕਿ ਮੈਨੂੰ ਦੋ ਹਜ਼ਾਰ ਰੁਪਇਆ ਹੋਰ ਦੇ ਕੇ ਐਪਲ ਦੇ ਏਅਰਪੋਡ ਸੈਕਿੰਡ ਜਨਰੇਸ਼ਨ ਵੀ ਨਾਲ਼ ਫ੍ਰੀ ਮਿਲ ਜਾਣਗੇ ਤਾਂ ਇਸ ਕਰਕੇ ਮੈਂ ਆਪਣਾ ਇੱਕ ਮਿੰਟ ਵੀ ਦੇਰੀ ਨਾ ਕਰਦੇ ਹੋਏ ਮੈਂ ਉਹ ਫ਼ੋਨ ਔਡਰ ਕਰ ਦਿੱਤਾ ਅਤੇ ਜਿਸ 'ਤੇ ਉਸਦਾ ਮੈਨੂੰ ਬਹੁਤ ਚਿਰ ਤੋਂ ਇੰਤਜ਼ਾਰ ਸੀ ਅਤੇ ਮੈਂ ਵੇਟ ਕਰਦਾ ਕਰਦਾ ਇੱਕ ਹਫ਼ਤਾ ਨਿਕਲ ਗਿਆ ਇੱਕ ਹਫ਼ਤੇ ਨਿਕਲਣ ਤੋਂ ਬਾਅਦ ਜਦੋਂ ਡਿਲ ਪਾਰਸਲ ਮੇਰੇ ਘਰ ਆਇਆ ਤਾਂ ਦੁਕਾਨਦਾਰ ਨੇ ਮੇਰੇ ਡਿਲੀਵਰੀ ਮੁੰਡੇ ਡਿਲੀਵਰੀ ਵਾਲੇ ਮੁੰਡੇ ਨੇ ਮੇਰੇ ਮੂਹਰੇ ਹੀ ਖੋਲ੍ਹਿਆ ਉਸ ਡੱਬੇ ਨੂੰ ਪਰ ਜਦੋਂ ਮੈਂ ਫ਼ੋਨ ਨਿਕਲਦਾ ਦੇਖਿਆ ਤਾਂ ਮੇਰਾ ਦਿਲ ਬਾਗ਼ੋ ਬਾਗ਼ ਹੋ ਗਿਆ ਕਿਉਂਕਿ ਉਹ ਮੇਰਾ ਮਨਪਸੰਦ ਰੰਗ ਸੀ ਅਤੇ ਨਾਲ਼ੇ ਮੇਰਾ ਮਨਪਸੰਦ ਫ਼ੋਨ ਸੀ ਅਤੇ ਉਹ ਇੱਕ ਸੌ ਅਠਾਈ ਜੀ ਬੀ ਦਾ ਛੇ ਜੀ ਬੀ ਰੋਮ ਅਤੇ ਬਾਰਾਂ ਮੈਗਾਪਿਕਸਲ ਦੇ ਦੋ ਇੱਕ ਮੇਨ ਕੈਮਰਾ ਅਤੇ ਬਾਰਾਂ ਮੈਗਾਪਿਕਸਲ ਦਾ ਅਲਟਰਾਵਾਇਲਟ ਕੈਮਰਾ ਹੈ ਉਹਦੇ ਵਿੱਚ ਜਿਸ ਦੇ ਨਾਲ਼ ਮੈਂ ਬਹੁਤ ਸੋਹਣੀਆਂ ਸੋਹਣੀਆਂ ਫੋਟੋ ਖਿੱਚ ਰਿਹਾ ਹਾਂ ਅਤੇ ਉਸਦੇ ਨਾਲ਼ ਨਾਲ਼ ਮੈਂ ਵੀਡੀਓਗ੍ਰਾਫੀ ਕਰਨ ਦਾ ਵੀ ਮੈਨੂੰ ਸ਼ੌਕ ਹੈ ਅਤੇ ਉਸ ਦੇ ਕਾਰਨ ਉਸ ਦੇ ਨਾਲ਼ ਮੈਂ ਆਪਣੀ ਵੀਡੀਓ ਰਿਕੋਡ ਕਰ ਕਰਕੇ ਮੈਂ ਆਪਣੇ ਯੂਟੀਊਬ ਚੈਨਲ ਉੱਤੇ ਪਾ ਰਿਹਾ ਹਾਂ ਜਿਸ ਦੇ ਕਰਕੇ ਮੈਂ ਪੈਸੇ ਵੀ ਕਮਾ ਪਾ ਰਿਹਾ ਹਾਂ ਉਸ ਕਰਕੇ ਉਹ ਮੇਰੇ ਲਈ ਇੱਕ ਇਨਵੈਸਟਮੈਂਟ ਹੈ ਨਾ ਕਿ ਉਹ ਮੇਰੇ ਲਈ ਕੋਈ ਲਾਈਵੀਲਿਟੀ ਹੈ ਇਸ ਕਰਕੇ ਮੈਂ ਬਹੁਤ ਖੁਸ਼ ਹਾਂ ਜਿਹੜਾ ਮੈਂ ਫੋਨ ਔਡਰ ਕਰਤਾ ਅਤੇ ਉਹ ਮੇਰੇ ਲਈ ਬਹੁਤ ਵਾਜਬ ਲੱਗਿਆ ਅਤੇ ਮੇਰੇ ਲਈ ਉਹ ਚੀਜ਼ ਬਹੁਤ ਲੱਕੀ ਹੈ ਅਤੇ ਉਸਦੇ ਨਾਲ਼ ਮੈਂ ਆਪਣੇ ਹਰ ਸੁਪਨਾ ਪੂਰਾ ਕਰ ਪਾ ਰਿਹਾ ਹਾਂ ਅਤੇ ਮੈਂ ਹੌਲੀ ਹੌਲੀ ਐਂਏ ਅੱਗੇ ਹੀ ਵੱਧਦਾ ਜਾਵਾਂਗਾ ਅਤੇ ਮੇਰਾ ਉਹ ਫ਼ੋਨ ਮੇਰੇ ਨਾਲ਼ ਹੀ ਰਹੇਗਾ